ਪੇਂਡੂ ਖੇਤਰਾਂ ਵਿੱਚ ਸਰਕਾਰੀ ਸ਼ਾਸਨ ਕਈ ਕਾਰਨਾਂ ਦੀ ਕਮੀ ਹੁੰਦੀ ਹੈ ਇਹ ਵੱਖ ਵੱਖ ਮੁਸ਼ਕਲਾਂ ਪੈਦਾ ਕਰਦੇ ਹਨ ਮਾੜੀ ਜਨਤਾ ਸੇਵਾ ਇਸ ਦਾ ਕਾਰਨ ਹੀ ਹੈ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਹਸਪਤਾਲ ਸਿੱਖਿਆ ਜਿਵੇਂ ਕਿ ਸਕੂਲ ਕਾਲਜ ਅਤੇ ਆਵਾਜਾਈ ਦੇ ਸਾਧਨ ਕਮੀ ਹੁੰਦੀ ਹੈ ਅਤੇ ਇੱਥੇ ਸਰਕਾਰੀ ਸਕੂਲ ਹਸਪਤਾਲ ਘੱਟ ਹੁੰਦੇ ਹਨ ਸ ਵਾਤਾਵਰਨ ਦਾ ਹਾਲ ਵੀ ਬਹੁਤ ਮਾੜਾ ਹੁੰਦਾ ਹੈ ਇਹ ਮਿੱਟੀ ਵਿੱਚ ਖਾਰਾਪਨ ਹੋਣ ਕਰਕੇ ਖੇਤੀਬਾੜੀ ਦੀ ਗਿਰਾਵਟ ਗਿਰਾਵਟ ਆ ਜਾਂਦੀ ਹੈ ਪਾਣੀ ਦੀ ਕਮੀ ਵੀ ਹੁੰਦੀ ਹਨ ਅਤੇ ਸਿਹਤ ਨਾਲ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਬੱਚਿਆਂ ਦੀ ਮੌਤ ਬ ਮੌਤ ਦਰ ਵੱਧ ਜਾਂਦੀ ਹੈ ਅਤੇ ਕਾਨੂੰਨ ਦੀ ਹਾਲਤ ਵੀ ਬਹੁਤ ਖ਼ਰਾਬ ਹੁੰਦੀ ਹੈ ਲੋਕਾਂ ਨੂੰ ਰੁਜ਼ਗਾਰ ਘੱਟ ਮਿਲਦਾ ਹੈ ਅਤੇ ਸਮਾਜਿਕ ਭੇਦ ਭਾਵ ਬਹੁਤ ਹੁੰਦਾ ਹੈ ਸਾਰੇ ਹੀ ਕਾਰਨ ਪੇਂਡੂ ਖੇਤਰਾਂ ਵਿੱਚ ਬਹੁਤ ਘਾਟਾ ਪਾਉਂਦੇ ਹਨ ਜਿਸ ਕਾਰਨ ਬਹੁਤ ਮੁਸ਼ਕਲਾਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਨੂੰ ਬਹੁਤ ਦੁਖੀ ਹੋਣਾ ਪੈਂਦਾ ਹੈ